ਬੱਚਿਆਂ ਦੀ ਦੇ ਉੱਤੇ ਬਹੁਤ ਹੀ ਜ਼ਿਆਦਾ ਹੁੰਦਾ ਹੈ ਜਿਨ ਅੱਜ ਕੱਲ੍ਹ ਦੇ ਬੱਚੇ ਜ਼ਿਆਦਾ ਕਰ ਫੋਨਾਂ ਵਿੱਚ ਹੀ ਲੱਗੇ ਰਹਿੰਦੇ ਹਨ ਜਿਸ ਕਾਰਨ ਬੱਚਿਆਂ ਦੇ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਇਸਰਾਨ ਪੈ ਜਾਂਦਾ ਹੈ ਤਾਂ ਕਰਕੇ ਬਚ ਬੱਚਿਆਂ ਦੇ ਕਈ ਤਰ੍ਹਾਂ ਦੀਆਂ ਗੇਮਾਂ ਫੋਨ ਵਿੱਚ ਡਾਊਨਲੋ ਕਰਦੇ ਹਨ ਜੋ ਕਿ ਗੂਗਲ ਪੇ ਵਿਚ ਨਾਲ ਐਡ ਊਡ ਕਰ ਲੈਂਦੇ ਹਨ ਨਾਲ ਦੀਆਂ ਫ਼ੈਲਾਂ ਬਣਾ ਲੈਂਦੇ ਹਨ ਅਤੇ ਫਿਰ ਘਰਦਿਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੇ ਹਨ ਅਤੇ ਉਹਨਾਂ ਦੇ ਵੀ ਪੈਸਿਆਂ ਦੇ ਇਹ ਪੈਸੇ ਖ਼ਰਾਬ ਹੋ ਜਾਂਦੇ ਹਨ ਅਤੇ ਬੱਚਿਆਂ 'ਤੇ ਵੀ ਬਹੁਤ ਜ਼ਿਆਦਾ ਹੋ ਜਾਂਦਾ ਏ ਕਿ ਕਿਉਂਕਿ ਬੱਚ ਜ਼ਿਆਦਾਤਰ ਜਵਾਕ ਜਦੋਂ ਫੋਨ ਲਈ ਰੱਖਦੇ ਹਨ ਉਹਨਾਂ ਦੇ ਅੱਖਾਂ ਨਿਗਾਹ ਘੱਟ ਜਾਂਦੀ ਹੈ ਅਤੇ ਫਿਰ ਐਨਕਾਂ ਲਵਾਉਣੀਆਂ ਪੈਂਦੀਆਂ ਹਨ ਅਤੇ ਬੱਚੇ ਜਦੋਂ ਜ਼ਿਆਦਾਤਰ ਗੇਮਾਂ ਖੇਡਦੇ ਹਨ ਅਤੇ ਉਹਨਾਂ ਦੀ ਦਿਮਾਗ ਦਿਮਾਗ 'ਤੇ ਵੀ ਲੱਗ ਜਾਂਦੇ ਹਨ ਅਤੇ ਇਸ ਨਾਲ ਜਵਾਕਾਂ ਵੀ ਹਮ ਜਵਾਕ ਵੀ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਹਨ ਅਤੇ ਉਹਨਾਂ ਉਹ ਆਪਣੀ ਦੇਖਭਾਲ ਜਮਾਂ ਵੀ ਹੀ ਨਹੀਂ ਕਰਦੇ ਹਨ ਅਤੇ ਬਿਮਾਰੀਆਂ ਬਹੁਤ ਸਾਰੀਆਂ ਲੱਗ ਜਾਂਦੀਆਂ ਹਨ ਜਦੋਂ ਉਹ ਦੇਖਭਾਲ ਨਹੀਂ ਕਰਦੇ ਇਸ ਲਈ ਬੱਚਿਆਂ ਨੂੰ ਜ਼ਿਆਦਾ ਟਾਈਮ ਫੋਨ ਨਹੀਂ ਦੇਖਣਾ ਚਾਹੀਦਾ ਅਤੇ ਜੇਕਰ ਉਹ ਜ਼ਿਆਦਾ ਟੈਮ ਫੋਨ ਦੇਖਦੇ ਹਨ ਤਾਂ ਉਹਨਾਂ ਦਾ ਪੜ੍ਹਾਈ ਵਿੱਚ ਵੀ ਜਮਾ ਵੀ ਮਨ ਨਹੀਂ ਕਰਦਾ ਅਤੇ ਜਵਾਕ ਪੜ੍ਹਨ ਵਿੱਚ ਵੀ ਭੋਰਾ ਬਿਲਕੁਲ ਹਿੱਸਾ ਨਹੀਂ ਲੈਂਦੇ ਅਤੇ ਬਿਲਕੁਲ ਹਿੱਸਾ ਨਹੀਂ ਲੈਂਦੇ ਅਤੇ ਪੜ੍ਹਾਈ ਵਿੱਚ ਵੀ ਹਮ ਨੰਬਰ ਨਹੀਂ ਲੈ ਲੈਂਦੇ ਅਤੇ ਇਸ ਲਈ ਜਵਾਕ ਫੇਲ ਹੋ ਜਾਂਦੇ ਨੇ ਇਸਲ ਇਸ ਕਰਕੇ ਬੱਚਿਆਂ ਨੂੰ ਫੋਨ ਘੱਟ ਤੋਂ ਘੱਟ ਦੇਖਣਾ ਚਾਹੀਦਾ ਹੈ ਨਾ ਅਤੇ ਆਪਣੀ ਦੇਖਭਾਲ ਕਰਨੀ ਚਾਹੀਦੀ ਹੈ